ਜੀ ਨਹੀਂ ਮੈਂ ਆਪਣੇ ਕੈਮਰੇ ਦੀ ਵਰਤੋਂ ਰੀਲਾਂ ਜਾਂ ਸ਼ਾਰਟਸ ਸ਼ੂਟ ਕਰਨ ਵਾਸਤੇ ਨਹੀਂ ਕਰਦਾ ਹਾਂ ਮੈਂ ਜ਼ਿਆਦਾਤਰ ਆਪਣੇ ਕੈਮਰੇ ਦਾ ਇਸਤੇਮਾਲ ਸਿਰਫ ਫੋਟੋਆਂ ਖਿੱਚਣ ਵਾਸਤੇ ਕਰਦਾ ਹਾਂ ਜਿਵੇਂ ਆਪਣੇ ਫੈਮਿਲੀ ਦੀ ਫੋਟੋ ਜਾਂ ਕਿਸੇ ਵਧੀਆ ਜਿਹੀ ਜਗ੍ਹਾ ਹੋਵੇ ਉਹਦੀ ਫੋਟੋ ਜਾਂ ਫਿਰ ਆਪਣੇ ਰਿਲੇਟਿਵਸ ਦੀ ਫੋਟੋਆਂ ਖਿੱਚਣ ਵਾਸਤੇ ਕਰਦਾ ਹਾਂ ਜਾਂ ਕੋਈ ਘਰ ਦਾ ਫੰਕਸ਼ਨ ਵਗੈਰਾ ਹੋਵੇ ਤਾਂ ਫਿਰ ਮੈਂ ਆਪਣਾ ਕੈਮਰਾ ਕੱਢ ਕੇ ਉਹਦੀ ਉਹਦੇ ਨਾਲ ਲੋਕਾਂ ਦੀਆਂ ਫੋਟੋਆਂ ਖਿੱਚਦਾ ਜਾਂ ਫਿਰ ਕੋਈ ਫੈਮਿਲੀ ਫੰਕਸ਼ਨ ਹੋਵੇ ਤਾਂ ਉਹਦੇ ਵਿੱਚ ਜਾ ਕੇ ਫੋਟੋਆਂ ਖਿੱਚਣਾ ਸਾਰਿਆਂ ਦੇ ਨਾਲ ਫੋਟੋਆਂ ਖਿਚਵਾਉਣਾ ਬੱਚਿਆਂ ਵਗੈਰਾ ਜਿੰਨੇ ਵੀ ਲੋਕ ਆਉਂਦੇ ਉਨ੍ਹਾਂ ਦੇ ਨਾਲ ਇੱਕ ਇੱਕ ਵਾਰੀ ਫੋਟੋ ਖਿਚਾ ਕੇ ਰੱਖਣਾ ਬੇਸਿਕਲੀ ਆਪਣੇ ਵਾਸਤੇ ਯਾਦਾਂ ਬਣਾਉਣ ਵਾਸਤੇ ਰੱਖਦਾ ਹਾਂ ਕੈਮਰਾ ਤਾਂ ਕਿ ਬਾਅਦ 'ਚ ਵੀ ਦੇਖ ਸਕਾਂ ਮੈਂ ਜਾਂ ਫਿਰ ਇੱਕ ਦੋ ਕਈ ਵਾਰੀ ਮੈਂ ਆਪਣੀ ਸੋਸ਼ਲ ਮੀਡੀਆ ਵਾਸਤੇ ਪੋਸਟ ਕਰਨ ਵਾਸਤੇ ਆਪਣੀ ਫੋਟੋਆਂ ਖਿੱਚਦਾ ਹਾਂ ਤਾਂ ਕਿ ਕੋਈ ਚੱਜ ਦੀ ਫੋਟੋ ਆ ਜਾਵੇ ਜੇ ਮੈਂ ਜਿਹੜੀ ਮੈਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕਰ ਸਕਾਂ ਰੀਲਾਂ ਵਗੈਰਾ ਵਾਸਤੇ ਨਹੀਂ ਕਰਦਾ ਮੈਂ ਬਿਲਕੁਲ ਯੂਜ ਕਿਉਂਕਿ ਮੇਰੇ ਕੋਲ ਜਿਹੜਾ ਕੈਮਰਾ ਮੋਸਟਲੀ ਯੂਜ ਹੀ ਸਿਰਫ ਫੋਟੋਆਂ ਵਗੈਰਾ ਵਾਸਤੇ ਆਉਂਦਾ ਵਾ